ਅੱਜ ਕੱਲ੍ਹ ਹਰ ਲੋਕ ਆਂ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਅੱਜ ਕੱਲ੍ਹ ਤਾਂ ਈ ਬੈਂਕਿੰਗ ਵੀ ਸ਼ੁਰੂ ਹੋਈ ਹੋਈ ਹੈ ਜਿਸ ਕਰਕੇ ਆਪਾਂ ਇਲੈਕਟਰੋਨਿਕ ਚੀ ਦੁਆਰਾ ਹੀ ਆਪਣੇ ਪੈਸੇ ਕਢਾ ਸਕਦਾ ਇੱਕ ਚਾਂਸ ਹੁੰਦਾ ਕਿ ਆਪਾਂ ਏ ਟੀ ਐਮ 'ਚ ਜਾ ਕੇ ਆਪਣਾ ਪਿੰਨ ਨੰਬਰ ਪਾ ਕੇ ਆਪਾਂ ਪੈਸੇ ਕਢਾ ਸਕਣ ਜਾਂ ਫਿਰ ਬੈਂਕ ਦੇ ਵਿੱਚ ਜਾਕਰ ਆਪਣਾ ਪੂਰਾ ਕ੍ਰਿਰਿਆਵਾਂ ਨੂੰ ਪੂਰਾ ਕਰਕੇ ਪੈਸੇ ਕਢਾ ਸਕਣ ਬੈਂਕ ਵਿੱਚ ਆਪਣੇ ਕਰਮਚਾਰੀ ਸਾਡੀ ਸਹਾਇਤਾ ਕਰਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਕੀ ਕੀ ਲਿਖਣਾ ਹੈ ਅਤੇ ਕੀ ਕੀ ਉਹਦੇ ਵਿੱਚ ਭਰਨਾ ਹੈਗਾ ਵੈ ਆਪਾਂ ਆਪਣਾ ਬੈਂਕ ਅਕਾਊਂਟ ਨੰਬਰ ਭਰਦੇ ਹਾਂ ਉਹ ਤੋਂ ਬਾਅਦ ਆਪਾਂ ਆਪਣੀ ਜਿੰਨੇ ਵੀ ਸਾਨੂੰ ਪੈਸੇ ਕਢਾਉਣੇ ਹੁੰਦੇ ਹਨ ਉਹਨੂੰ ਲਿਖਦੇ ਹਾਂ ਫਿਰ ਆਪਾਂ ਮਿਤੀ ਪਾਉਂਦੇ ਹਾਂ ਮਿਤੀ ਪਾਉਣ ਤੋਂ ਬਾਅਦ ਆਪਾਂ ਉਹ ਜਿਹੜਾ ਪੇਪਰ ਹੈਗਾ ਵੈ ਜਿਹੜਾ ਉਹਨੂੰ ਆਪਾਂ ਇੱਕ ਕਰਮਚਾਰੀ ਨੂੰ ਫੜਾ ਦਿੰਦੇ ਹਾਂ ਜੋ ਸਾਨੂੰ ਉ ਉਹ ਸਟੈਂਪ ਲਾਉਣ ਤੋਂ ਬਾਅਦ ਸਾਨੂੰ ਕੈਸ਼ੀਅਰ ਤੋਂ ਜਾਣਾ ਪੈਂਦਾ ਹੈ ਕੈਸ਼ੀਅਰ ਤੋਂ ਜਾਣ ਤੋਂ ਬਾਅਦ ਆਪਾਂ ਉਹਦੇ ਕੋਲ ਪੈਸੇ ਕਢਵਾ ਲੈਂਦੇ ਹਾਂ ਅਤੇ ਕੈਸ਼ੀਅਰ ਸਾਡੇ ਕੋਲੋਂ ਸਾਈਨ ਮੰਗਦਾ ਹੈ ਇੱਕ ਸਾਈਨ ਹੀ ਹੈਗਾ ਹੈ ਜੋ ਸਾਨੂੰ ਬਚਾ ਕੇ ਰੱਖਦਾ ਹੈ ਕਿ ਕੋਈ ਦੂਜਾ ਇਨਸਾਨ ਸਾਡੇ ਪੈਸੇ ਨਾ ਕਢਾ ਸਕੇ ਅਗਰ ਤੁਸੀਂ ਏ ਟੀ ਐਮ ਤੋਂ ਪੈਸੇ ਕਢਾਉਣੇ ਹੈਗੇ ਆ ਤਾਂ ਤੁਸੀਂ ਏ ਟੀ ਐਮ 'ਚ ਜਾ ਕੇ ਆਪਣਾ ਚਾਰ ਨੰਬਰ ਦਾ ਪਿੰਨ ਕੋਡ ਪਾਉਣਾ ਹੈਗਾ ਅਤੇ ਪਿੰਨ ਕੋਡ ਪਾਉਣ ਤੋਂ ਬਾਅਦ ਤੁਸੀਂ ਆਪਣੇ ਪੈਸੇ ਦੀ ਰਕਮ ਲਿਖਣੀ ਆ ਅਤੇ ਤੁਸੀਂ ਕਿਸੇ ਵਿੱਚ ਕਿਹੜੀ ਰਕਮ ਚਾਹੁੰਦੇ ਹੋ ਪੰਜ ਸੌ ਦੇ ਵਿੱਚ ਹਜ਼ਾਰ ਦੇ ਵਿੱਚ ਜਾਂ ਫਿਰ ਸੌ ਰੁਪਏ ਦੇ ਵਿੱਚ ਤੁਸੀਂ ਉਹ ਰਕਮ ਪਾਉਣ ਤੋਂ ਬਾਅਦ ਤੁਹਾਨੂੰ ਪੈਸੇ ਦੀ ਉਪਲਬਧੀ ਹੋ ਜਾਂਦੀ ਹੈ ਅਤੇ ਅੱਜ ਤੋਂ ਨਵੇਂ ਤਰੀਕੇ ਦੇ ਨਾਲ ਹੀ ਪੈਸੇ ਕਢਾਉਣ ਦਾ ਨਤੀਜਾ ਆਇਆ ਹੈ ਆਪਾਂ ਤਾਂ ਕਿਸੇ ਦੇ ਦੁਆਰਾ ਇੱਕ ਫੋਨ ਤੋਂ ਦੂਜੇ ਫੋਨ 'ਤੇ ਪੈਸੇ ਦੀ ਟ੍ਰਾਂਸਲੇਸ਼ਨ ਕਰ ਸਕਦੇ ਹਾਂ ਜਿਸ ਕਰਕੇ ਉਹ ਟਰਾਂਸਲੇਸ਼ਨ ਆਪਾਂ ਬਾਅਦ 'ਚੋਂ ਬੈਂਕ ਤੋਂ ਜਾ ਕੇ ਆਪਣੇ ਏ ਟੀ ਐਮ ਤੋਂ ਜਾ ਕੇ ਕਢਾ ਸਕਦੇ ਹਾਂ